ਸੋ ਮੈਂ ਇੱਕ ਵਾਰ ਇੱਕ ਬੁੱਕ ਪੜ੍ਹੀ ਸੀ ਜਿਸਨੇ ਮੈਨੂੰ ਬੌਧਿਕ ਤੌਰ 'ਤੇ ਚੁਣੌਤੀ ਦਿੱਤੀ ਸੀ ਸੋ ਮੈਂ ਅੱਜ ਗੱਲ ਕਰਨ ਜਾ ਰਹੀ ਹਾਂ ਉਹ ਬੁੱਕ ਦੀ ਜਿਹਦਾ ਨਾਮ ਹੈ ਡੋਂਟ ਜੱਜ ਆ ਬੁੱਕ ਬਾਏ ਇੱਟਸ ਕਵਰ ਵਿੱਚ ਇਜ਼ ਰਿਟਨ ਬਾਏ ਜੋਰਜ ਐਲੀਟ ਸੋ ਜਦੋਂ ਮੈਂ ਇਹ ਬੁੱਕ ਪੜ੍ਹੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਸਾਨੂੰ ਕਿਸੇ ਨੂੰ ਕਿਸੇ ਦੀ ਅਪੀਅਰੈਂਸ ਤੋਂ ਜੱਜ ਨਹੀਂ ਕਰਨਾ ਚਾਹੀਦਾ ਲੋਕ ਤਾਂ ਬੜੀ ਜਲਦੀ ਹੀ ਕਿਸੇ ਦੇ ਚਿਹਰੇ ਕਿਸੇ ਦੇ ਕੱਪੜਿਆਂ ਤੋਂ ਇਹ ਜੱਜ ਕਰ ਲੈਂਦੇ ਹਨ ਕਿ ਉਹ ਅਮੀਰ ਹੈ ਗਰੀਬ ਹੈ ਉਹ ਵਧੀਆ ਹੈ ਜਾਂ ਉਸਦਾ ਸੁਭਾਅ ਘਟੀਆ ਹੈ ਪਰ ਜਦੋਂ ਮੈਂ ਇਹ ਬੁੱਕ ਪੜ੍ਹੀ ਤਾਂ ਮੈਨੂੰ ਇਹ ਫੀਲ ਹੋਇਆ ਵੀ ਸਾਨੂੰ ਕਦੀ ਵੀ ਕਿਸੇ ਦੀ ਅਪੀਅਰੈਂਸ ਤੋਂ ਉਸਨੂੰ ਜੱਜ ਕਰਨਾ ਚਾਹੀਦਾ ਜਦੋਂ ਕਿ ਕਈ ਵਾਰ ਤਾਂ ਕੋਈ ਬੰਦਾ ਬਹੁਤ ਹੀ ਸੋਹਣਾ ਹੁੰਦਾ ਹੈ ਪਰ ਉਹ ਦਿਲ ਦਾ ਸਾਫ਼ ਨਹੀਂ ਹੁੰਦਾ ਉਹ ਜਦੋਂ ਬੋਲਦਾ ਹੈ ਤਾਂ ਉਹ ਇੰਨਾ ਕੜਵਾ ਬੋਲਦਾ ਹੈ ਕਿ ਉਹ ਮਨ 'ਤੇ ਬਹੁਤ ਹੀ ਗੰਦਾ ਪ੍ਰਭਾਵ ਪਾਉਂਦਾ ਹੈੇ ਪਰ ਕੋਈ ਲੋਕ ਸੋਹਣੇ ਨਹੀਂ ਹੁੰਦੇ ਪਰ ਉਹਨਾਂ ਦੀ ਆਵਾਜ਼ ਇੰਨੀ ਮਿੱਠੀ ਹੁੰਦੀ ਹੈ ਅਤੇ ਉਹਨਾਂ ਦਾ ਦਿਲ ਵੀ ਸਾਫ਼ ਹੁੰਦਾ ਹੈ ਸੋ ਇਸ ਕਰਕੇ ਸਾਨੂੰ ਕਦੀ ਵੀ ਕਿਸੇ ਦੇ ਚਿਹਰੇ ਜਾਂ ਉਸਦੀ ਅਪੀਅਰੈਂਸ ਤੋਂ ਉਸਨੂੰ ਜੱਜ ਨਹੀਂ ਕਰਨਾ ਚਾਹੀਦਾ ਸੋ ਇਹ ਬੁੱਕ ਨੇ ਮੇਰੇ ਲਈ ਇੱਕ ਲਾਈਫ ਚੈਲੇਂਜਿੰਗ ਰੋਲ ਪਲੇਅ ਕੀਤਾ ਅਤੇ ਮੈਨੂੰ ਅਹਿਸਾਸ ਹੋ ਗਿਆ ਕਿ ਸਾਨੂੰ ਕਦੀ ਵੀ ਕਿਸੇ ਦੀ ਅਪੀਅਰੈਂਸ ਤੋਂ ਉਸਨੂੰ ਜੱਜ ਨਹੀਂ ਕਰਨਾ ਚਾਹੀਦਾ ਅਤੇ ਇਸ ਬੁੱਕ ਨੂੰ ਮੈਂ ਆਪਣੇ ਪਰਿਵਾਰ ਜਾਂ ਦੋਸਤਾਂ ਨਾਲ ਵੀ ਸ਼ੇਅਰ ਕੀਤਾ ਅਤੇ ਉਹਨਾਂ ਨੂੰ ਵੀ ਮੈਂ ਕਿਹਾ ਕਿ ਤੁਸੀਂ ਇਸ ਬੁੱਕ ਨੂੰ ਪੜ੍ਹੋ ਅਤੇ ਇਸ ਨੂੰ ਸਮਝੋ